ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਖਵੀਰ ਠਾਕੁਰ ਬੋਲਦੇ ਜੀ ਭਾਅ ਜੀ ਮੈਨੂੰ ਤੁਹਾਡਾ ਨੰਬਰ ਰਾਮ ਸਿੰਘ ਨੇ ਦਿੱਤਾ ਤਾ ਜੀ ਮੈਨੂੰ ਨਾ ਜੀ ਜਲੰਧਰ ਕਪੂਰਥਲਾ ਰੋਡ ਪਰ ਜੀ ਤਿੰਨ ਚਾਰ ਦੁਕਾਨਾਂ ਇਕੱਠੀਆਂ ਹੋਣ ਵਿੱਚ ਘਰ ਘੁਰ ਵੀ ਹੋਵੇ ਉਹਦੇ ਵਾਸਤੇ ਹੀ ਰੈਂਟ ਪਰ ਚਾਹੀਦੀਆ ਤੀਆਂ ਹਾਂ ਮੈਡੀਕਲ ਥ ਮੈਡੀਕਲ ਪਰਪਸ ਵਾਸਤੇ ਵਿੱਚ ਦੋਆਨ ਦੋ ਦੁਕਾਨਾਂ 'ਚ ਹਸਪਤਾਲ ਬਣਾ ਦੂੰਗੇ ਜੀ ਇੱਕ 'ਚ ਆਪਣਾ ਮੈਡੀਕਲ ਸਟੋਰ ਹੋ ਗਿਆ ਅਤੇ ਇੱਕ ਆਪਣਾ ਫਿਰ ਥੋੜ੍ਹਾ ਬਹੁਤਾ ਰਹਿਣ ਸਹਿਣ ਲਈ ਵੀ ਦੇਖ ਲੂੰਗੇ ਜੇ ਘਰ ਮਿਲਦਾ ਵਿੱਚ ਉਹ ਵੀ ਬੈਸਟ ਆ ਹਾਂਜੀ ਚੱਲ ਜੂੰਗਾ ਤੁਸੀਂ ਰੈਂਟ ਰੁੰਟ ਦੀ ਗੱਲ ਖੋਲ ਲਓ ਜੀ ਕਿੰਨੇ ਦਾ ਕਿਆ ਹੈ ਕਿੰਨੇ ਪਰ ਮੰਥ ਕਿੰਨਾ ਚੱਲਦਾ ਰੇਟ ਜੀ ਅੱਛਾ ਜੀ ਚੱਲੋ ਰਹਿਣੇ ਵਾਲੇ ਦਾ ਸਰਜੂੰਗਾ ਦੁਕਾਨਾਂ ਦੀ ਦੱਸ ਦਿਓ ਜੀ ਦੁਕਾਨ ਥੋੜ੍ਹੀ ਬੜੀ ਚਾਹੀਦੀ ਹਸਪਤਾਲ ਵੀ ਖੋਲਣਾ ਨੇ ਵਿੱਚ ਫਿਰ ਫਿਰ ਮੈਡੀਕਲ ਸਟੋਰ ਵੀ ਹੋ ਗਿਆ ਅੱਛਾ ਜੀ ਅੱਛਾ ਅੱਛਾ ਜੀ ਇਹ ਫਿਰ ਇਹ ਜਲੰਧਰ ਕਪੂਰਥਲਾ ਰੋਡ ਪਰੇ ਮਿਲਜੂੰਗੀ ਵੀ ਦੁਕ ਦੁਕਾਨ ਆਪਣੇ ਪਾਸੇ ਹੋਵੇ ਅਤੇ ਰੋਡ ਕਿਤੇ ਦੂਜੇ ਪਾਸੇ ਨਿਕਲਦੀ ਹੋਵੇ ਫਿਰ ਕਸਟਮਰ ਵੀ ਆਉਣ 'ਚ ਥੋੜ੍ਹੇ ਜਿਹੇ ਹਿੱਚਕਚਾਉਂਦੇ ਆ ਅੱਛਾ ਉਹ ਤਾਂ ਹੋਊਂਗੇ ਜੀ ਪਹਿਲਾਂ ਪੇਮੈਂਟ ਕਿੰਨੀ ਕਰਨੀ ਪੈਣੀ ਜਿਹੜੀ ਫਿਕਸਡ ਕਰਵਾਉਣੀ ਪੈਣੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਅਤੇ ਭਾਅ ਜੀ ਫਿਰ ਇਹ ਆਪਾਂ ਨੂੰ ਜਿਹੜੇ ਕੋਰਟ 'ਚ ਜਾ ਕੇ ਕੰਟਰੈਕਟ ਕਰਨਾ ਪਊਂਗਾ ਨਾ ਇਹਦਾ ਵਾਸਤੇ ਵੀ ਸਿਕਿਉਰਿਟੀ ਸਕਿਊਰਟੀ ਵਾਲਾ ਜੋ ਵੀ ਕਾਗਜ਼ ਪੱਤਰਾਂ ਦਾ ਕੰਮ ਆ ਅੱਛਾ ਜੀ ਇਹ ਭਾਅ ਜੀ ਇਹ ਦੁਕਾਨਾਂ ਦਾ ਤਾਂ ਹੋ ਗਿਆ ਥੋੜ੍ਹੇ ਜਿਹੇ ਐਂ ਵੀ ਸਾਨੂੰ ਸਟਾਫ ਵੀ ਚਾਹੀਦਾ ਸਟਾਫ ਦੀ ਰਿਕੁਾਇਰਮੈਂਟ ਜਿਹੀ ਵੀ ਆ ਉਹਦੇ ਵਾਸਤੇ ਵੀ ਅਸੀਂ ਪਤਾ ਕਰ ਰਹੇ ਹਾਂ ਜੀ ਮੈਡੀਕਲ ਪਰਪਸ ਵਾਸਤੇ ਚਾਹੀਦਾ ਜੀ ਦੋ ਕੁ ਤਾਂ ਹੈਗੇ ਆ ਦੋ ਕੁ ਚਾਹੀਦੇ ਆ ਵੈਸੇ ਪ੍ਰੈਫਰੈਂਸ ਸੈਲਰੀ ਜੋ ਡੀ ਸੀ ਰੇਟ ਚੱਲਦਾ ਉਹ ਦੇਖ ਲੂੰਗੇ ਬਾਕੀ ਜੇ ਅਸੀਂ ਓਵਰ ਟਾਈਮ ਕਰਾਉਂਗੇ ਉਹਨਾਂ ਵਾਸਤੇ ਅਲੱਗ ਆ ਜੀ ਪੇ ਹਾਂਜੀ ਹਾਂਜੀ ਕੰਟੀਨ ਵਿੱਚ ਹਸਪਤਾਲ ਦੇ ਵਿੱਚ ਦੇਣੀ ਓ ਪਊਗੀ ਜੀ ਹਾਂਜੀ ਹਾਂ ਡਿਊਟੀ ਅੱਠ ਘੰਟੇ ਦੀ ਸਾਨੂੰ ਉਹ ਹੀ ਆ ਨਾ ਨਾਈਟ ਸ਼ਿਫਟ ਵਾਸਤੇ ਵੀ ਥੋੜ੍ਹੇ ਜਿਹੇ ਵਰਕਰ ਚਾਹੀਦੇ ਫਿਰ ਰੋਟੇਟ ਕਰ ਲਿਆ ਕਰੂੰਗੇ ਜੀ ਅੱਛਾ ਜੀ ਹਾਂ ਹਾਂਜੀ ਸਾਡੀ ਜਿਹੜੀ ਉਹ ਆ ਜੀ ਜਿਹੜੀ ਫੀਮੇਲ ਵਾਸਤੇ ਜ਼ਿਆਦਾ ਵੀ ਫੀਮੇਲ ਨਰਸ ਮਿਲ ਜਾਵੇ ਜੇ ਡਾਕਟਰ ਮਿਲ ਜਾਵੇ ਤਾਂ ਬੈਸਟ ਆ ਨਹੀਂ ਨਹੀਂ ਸਾਨੂੰ ਮੋਰਨਿੰਗ ਚੱਲ ਜੂੰਗੇ ਫਿਰ ਰਾਤ ਨੂੰ ਤਾਂ ਕੋਈ ਵੀ ਕਰ ਸਕਦਾ ਜਿਕਣਾ ਮੈਂ ਹੋ ਗਿਆ ਇਕੱਲਾ ਜੇ ਬਸ ਆਹ ਦੁਕਾਨਾਂ ਦਾ ਰੈਂਟ ਰੁੰਟ ਦੱਸ ਦਿਓ ਤੋ ਫਿਰ ਅਸੀਂ ਅੱਛਾ ਜੀ ਚਾਰ ਦੁਕਾਨਾਂ ਹੈ ਜੀ ਚਾਰ ਦੁਕਾਨਾਂ ਜੀ ਅੱਛਾ ਜੀ ਉੱਪਰ ਉਹ ਰੂਮ ਆ ਜੀ ਠੀਕ ਹੈ ਇਹ ਟੋਟਲ ਕਿੰਨਾ ਬਣਦਾ ਜੀ ਅਮਾਊਂਟ ਇਹਦਾ ਅੱਛਾ ਜੀ ਅਤੇ ਕੁੱਲ ਮਿਲਾ ਕੇ ਉਹ ਹੀ ਸੱਤਰ ਕੁ ਹਜ਼ਾਰ ਦੇ ਕਰੀਬ ਬਣ ਗਿਆ ਅੱਛਾ ਜੀ ਅੱਛਾ ਜੀ ਨਹੀਂ ਇੱਕ ਇੱਕ ਦੁਕਾਨ ਦਾ ਅਠਾਰਾਂ ਹਜ਼ਾਰ ਆ ਅੱਛਾ ਜੀ ਸਾਰੀਆਂ ਦਾ ਮੈਨੂੰ ਲੱਗਿਆ ਇੱਕ ਦੁਕਾਨ ਦਾ ਹੀ ਹੈ ਚੱਲੋ ਫਿਰ ਤਾਂ ਠੀਕ ਆ ਜੀ ਚੱਲੋ ਆ ਮਿਲਦੇ ਹਾਂ ਫਿਰ ਅਗਲੇ ਸੰਡੇ ਜੀ ਫਿਰ ਤੁਹਾਨੂੰ ਆਈ ਕਾਲ ਕਰਕੇ ਤੁਹਾਨੂੰ ਮੈਂ ਬੁਲਾ ਲੂੰਗਾ ਉੱਥੇ ਹਾਂਜੀ ਓਕੇ ਧੰਨਵਾਦ